ਮੇਰੇ ਕੋਲ ਪੁਰਾਣੇ ਸਿੱਕਿਆਂ ਦਾ ਖ਼ਜ਼ਾਨਾ ਪਿਆ ਹੈ ਜੋ ਕਿ ਮੇਰੇ ਮਾਂ ਬਾਪ ਦੀ ਨਿਸ਼ਾਨੀ ਹੈ ਉਹ ਤਾਂ ਹੁਣ ਨਹੀਂ ਰਹੇ ਪਰ ਉਹ ਜਿਹੜੇ ਸਿੱਕੇ ਹਨ ਉਹ ਮੇਰੇ ਕੋਲ ਉਹਨਾਂ ਦੀ ਨਿਸ਼ਾਨੀ ਪਈ ਹੈ ਜੋ ਕਿ ਜਿਨ੍ਹਾਂ ਦੇ ਵਿੱਚ ਕਈ ਪੈਸੇ ਉੱਨੀ ਸੌ ਸੰਤਾਲੀ ਤੋਂ ਵੀ ਪਹਿਲਾਂ ਦੇ ਹਨ ਚਾਂਦੀ ਦੇ ਰੁਪਈਏ ਅਤੇ ਮੋਰੀ ਵਾਲੇ ਪੈਸੇ ਘੋੜੇ ਵਾਲੇ ਪੈਸੇ ਆਨੇ ਚੁਆਨੀਆਂ ਅਠਿਆਨੀਆਂ ਅਤੇ ਇੱਕਾ ਦੁੱਕੀ ਪੈਸੇ ਜਿਹਨਾਂ ਦਾ ਨਾਮ ਹੁੰਦਾ ਸੀ ਨਿੱਕਾ ਪੈਸਾ ਅਠਿਆਨੀ ਨੂੰ ਚੁਆਨੀ ਚੁਆਨੀ ਨੂੰ ਚੁਆਨੀ ਕਹਿਣਾ ਚੁਆਨੀ ਅਠਿਆਨੀ ਹੁਣ ਤਾਂ ਨੋਟ ਗਿਣੇ ਜਾਂਦੇ ਹਨ ਉਦੋਂ ਅਠਿਆਨੀਆਂ ਚੁਆਨੀਆਂ ਹੁੰਦੀਆਂ ਸਨ ਉਦੋਂ ਉਦੋਂ ਇਹਨਾਂ ਪੈਸਿਆਂ ਦੀ ਕੋਈ ਕੀਮਤ ਬਹੁਤ ਘੱਟ ਹੁੰਦੀ ਸੀ ਜੋ ਕਿ ਹੁਣ ਉਹ ਉਹਨਾਂ ਦੀ ਕੀਮਤ ਬਹੁਤ ਵੱਧ ਗਈ ਹੈ ਉਹ ਸੋਨੇ ਦੇ ਬਰਾਬਰ ਮਿਲਦੇ ਹਨ ਪਹਿਲੀ ਗੱਲ ਤਾਂ ਕਿਸੇ ਦੇ ਕੋਲ ਹੈ ਹੀ ਨਹੀਂ ਜੇ ਕਿਸੇ ਦੇ ਕੋਲ ਹੋਣਗੇ ਤਾਂ ਉਹ ਇਹਨਾਂ ਨੂੰ ਸੰਭਾਲ ਕੇ ਰੱਖੇ ਇਸ ਖ਼ਜ਼ਾਨੇ ਨੂੰ ਇਹ ਬਹੁਤ ਨਿਆਮਤ ਚੀਜ਼ ਹੈ ਅਮੋਲਕ ਹੀਰੇ ਹਨ ਜੋ ਕਿ ਗੁਜ਼ਰ ਚੁੱਕੀਆਂ ਗੁਜ਼ਰ ਚੁੱਕੇ ਟਾਈਮ ਦੇ ਵਿੱਚੋਂ ਦੀ ਲੰਘਦੇ ਹਨ ਸੋ ਇਸ ਨੂੰ ਆਪਾਂ ਬਹੁਤ ਸੰਭਾਲ ਕੇ ਰੱਖਣਾ ਹੈ ਇਸ ਵਿਰਸੇ ਨੂੰ ਗਵਾਉਣਾ ਨਹੀਂ ਚਾਹੁੰਦੇ ਅਤੇ ਵਾਹਿਗੁਰੂ ਇਸ ਤਰ੍ਹਾਂ ਹੀ ਸਭ ਨੂੰ ਸੁਮੱਤ ਬਖਸ਼ੇ ਅਤੇ ਉਹਨਾਂ ਦੇ ਕੋਲ ਇਹ ਚੀਜ਼ਾਂ ਬੱਚੇ ਆਪਣੇ ਮੈਂ ਚਾਹੁੰਦੀ ਹਾਂ ਕਿ ਮੇਰੇ ਘਰ ਦੇ ਵਿੱਚ ਮੇਰੇ ਬੱਚੇ ਮੇਰੇ ਪੋਤੇ ਪੋਤੀਆਂ ਇਹਨੂੰ ਵੇਖ ਕੇ ਯਾਦ ਕਰਨ ਨਾਲੇ ਇਹਨਾਂ ਨੂੰ ਪਤਾ ਲੱਗੇ ਬਈ ਇਹੋ ਜਿਹੇ ਪੈਸੇ ਚੱਲਦੇ ਹੁੰਦੇ ਸੀ ਜੋ ਕਿ ਵੇਖ ਕੇ ਕਈ ਤਾਂ ਬਹੁਤ ਹੱਸਦੇ ਹਨ ਅਤੇ ਕਈ ਬਹੁਤ ਮਤਲਬ ਕਿ ਹੈਰਾਨ ਹੁੰਦੇ ਹਨ ਅਤੇ ਇਹੋ ਜਿਹੇ ਪੈਸੇ ਆ ਜਿਹਨਾਂ ਨੇ ਨੋਟ ਵੇਖੇ ਹਨ ਉਹਨਾਂ ਨੇ ਇਹ ਸਿੱਕੇ ਨਹੀਂ ਵੇਖੇ ਸੋ ਇਸ ਕਰਕੇ ਵੀ ਅਸੀਂ ਕਹਿੰਦੇ ਹਾਂ ਬਈ ਚਲੋ ਇਹ ਖ਼ਜ਼ਾਨਾ ਪਿਆ ਰਹੇ ਚਲੋ ਸਾਡੇ ਬੱਚਿਆਂ ਦੀ ਇਹ ਵੀ ਇੱਕ ਹਿਸਾਬ ਦੀ ਜਾਇਦਾਦ ਹੀ ਹੈ ਕਿ ਉਹਨਾਂ ਨੂੰ ਵੇਖਣ ਅਤੇ ਸੰਭਾਲਣ